ਦੇਖੋ ਜਿਹੜੇ ਪੰਜਾਬ 'ਚ ਮੁੱਖ ਧਰਮ ਨੇ ਉਹ ਹੈਗੇ ਇੱਕ ਤਾਂ ਸਿੱਖ ਧਰਮ ਹੋ ਗਿਆ ਜੀ ਅਤੇ ਹੋ ਗਿਆ ਹਿੰਦੂ ਧਰਮ ਅਤੇ ਜਿਵੇਂ ਸੱਭਿਆਚਾਰ 'ਤੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜੀ ਕਿਉਂਕਿ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਉਹ 'ਚ ਗੁਰਮੁਖੀ ਪੰਜਾਬੀ ਭਾਸ਼ਾ ਜਿਹੜੀ ਹੈਗੀ ਉਹਦਾ ਬੜਾ ਵੱਡਾ ਜਿਹੜਾ ਇੱਕ ਰੋਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਨੇ ਉਹ ਪੰਜਾਬੀ 'ਚ ਲਿਖੇ ਹੋਏ ਨੇ ਜੀ ਅਤੇ ਸੱਭਿਆਚਾਰ ਦੀ ਆਪਾਂ ਜਿਵੇਂ ਗੱਲ ਕਰੀਏ ਜੇ ਆਪਾਂ ਪਹਿਰਾਵੇ ਹੋਗੇ ਜਾਂ ਗੀਤ ਹੋ ਗਏ ਜਿਹੜੇ ਪੰਜਾਬੀ ਲੋਕ ਗੀਤ ਨੇ ਉਹ ਵੀ ਪੰਜਾਬੀ 'ਚ ਹੀ ਲਿਖੇ ਹੋਏ ਨੇ ਜੀ ਅਤੇ ਉਹ ਇਕੱਲਾ ਪੰਜਾਬ ਨਹੀਂ ਜੀ ਜਿਹੜੇ ਪੰਜਾਬੀ ਦੇਸ਼ ਤੋਂ ਬਾਹਰ ਵੀ ਰਹਿੰਦੇ ਨੇ ਕਨੇਡਾ ਅਮਰੀਕਾ ਉਹਨਾਂ 'ਤੇ ਵੀ ਉਹ ਸੁਣਦੇ ਨੇ ਅਤੇ ਪੰਜਾਬੀ ਭਾਸ਼ਾ ਦੀ ਇੱਥੋਂ ਮਾਰ ਦਾ ਪਤਾ ਲੱਗਦਾ ਕਿ ਕਿੰਨੀ ਦੂਰ ਤੱਕ ਆਪਣੀ ਮਾਰ ਹੈ ਅਤੇ ਜੇ ਆਪਾਂ ਰਾਜ ਦੇ ਇਤਿਹਾਸ ਦੀ ਗੱਲ ਕਰੀਏ ਅਤੇ ਜਿਵੇਂ ਜਦੋਂ ਵੋਟਾਂ ਵੀ ਹੁੰਦੀਆਂ ਨੇ ਜੀ ਤਾਂ ਵੀ ਜਿਹੜੇ ਸਿੱਖ ਧਰਮ ਦੀਆਂ ਵੋਟਾਂ ਜ਼ਿਆਦਾ ਨੇ ਕਿਉਂਕਿ ਸਿੱਖ ਜ਼ਿਆਦਾ ਰਹਿੰਦੇ ਨੇ ਹਿੰਦੂ ਹਿੰਦੂ ਵੀ ਰਹਿੰਦੇ ਨੇ ਜੀ ਅਤੇ ਵੋਟਾਂ ਵੇਲੇ ਵੀ ਫਿਰ ਕਈ ਵਾਰੀ ਧਰਮ ਦਾ ਨਾਂ ਵਰਤ ਕੇ ਵੋਟਾਂ ਲੋਕ ਲੈ ਲੈਂਦੇ ਨੇ ਬਾਕੀ ਹਲੇ ਜੈਨਿਜ਼ਮ ਹੋ ਗਿਆ ਜਾਂ ਬਾਕੀ ਧਰਮ ਹੋ ਗਏ ਉਹ ਹਾਲੇ ਪੰਜਾਬ 'ਚ ਘੱਟ ਨੇ ਜੀ ਤਾਂ ਪੰਜਾਬ ਵਿੱਚ ਜਿਹੜੇ ਮੁੱਖ ਧਰਮ ਨੇ ਉਹ ਸਿੱਖ ਕਹਿ ਸਕਦੇ ਹਾਂ ਜੀ ਆਪਾਂ ਤਾਂ ਹਿੰਦੂ ਧਰਮ ਕਹਿ ਸਕਦੇ ਹਾਂ ਅਤੇ ਇਤਿਹਾਸ ਦੀ ਗੱਲ ਕਰੀਏ ਜੀ ਇਤਿਹਾਸ ਬਹੁਤ ਭਰਿਆ ਹੋਇਆ ਬਹੁਤ ਸ਼ਹੀਦੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ ਜੀ ਬੱਚਿਆਂ ਨੂੰ ਸਕੂਲਾਂ 'ਚ ਵੀ ਪੜ੍ਹਾਇਆ ਜਾਂਦਾ ਇਤਿਹਾਸ ਕਿਤਾਬਾਂ 'ਚ ਸਾਖੀਆਂ 'ਚ ਮਾਂ ਪਿਓ ਵੱਲੋਂ ਵੀ ਬੱਚਿਆਂ ਨੂੰ ਜਿਹੜਾ ਹੈਗਾ ਧਰਮਾਂ ਦਾ ਇਤਿਹਾਸ ਦਿੱਤਾ ਜਾਂਦਾ ਤਾਂ ਕਿ ਬੱਚੇ ਜਿਹੜੇ ਹੈਗੇ ਨੇ ਉਹ ਡਿਸਿਪਲਿਨ 'ਚ ਰਹਿਣ ਸਿੱਧੇ ਰਾਹ ਪਏ ਰਹਿਣ ਜ਼ਿੰਦਗੀ 'ਚ ਕਿਉਂਕਿ ਜਿਹੜਾ ਧਰਮ ਹੈ ਜੀ ਉਹ ਡਿਸਿਪਲਿਨ ਹੀ ਸਿਖਾਉਂਦਾ ਅਤੇ ਇੱਕ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦਾ ਜੀ